ਆਧੁਨਿਕ ਸੰਸਾਰ ਵਿੱਚ ਪੰਜਾਬੀ ਭਾਸ਼ਾ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਕੱਲ੍ਹ ਅੱਜ ਕੱਲ੍ਹ ਦੇ ਪੰਜਾਬੀ ਨੌਜਵਾਨਾਂ ਨੂੰ ਬਾਹਰ ਜਾਣ ਦਾ ਬਾਹਰ ਜਵਾ ਜਾਣ ਦਾ ਸ਼ੌਕ ਚੜਿਆ ਹੋਇਆ ਹੈ ਜੋ ਤਾਂ ਇਸ ਲਈ ਉਹ ਕਿ ਪੰਜਾਬੀ ਭਾਸ਼ਾ ਤੋਂ ਹਟ ਕੇ ਅੰਗਰੇਜ਼ੀ ਭਾਸ਼ਾ ਵੱਲ ਜਾ ਰਹੇ ਹਨ ਜੋ ਕਿ ਬਿਲਕੁਲ ਸਹੀ ਨਹੀਂ ਹੈ ਉਹ ਆਪਣੀ ਮਾਤ ਬੋਲੀ ਨੂੰ ਭੁੱਲਦੇ ਜਾ ਰਹੇ ਹਨ ਅਤੇ ਦੂਜੇ ਦੂਸਰੇ ਦੇਸ਼ਾਂ ਦੀ ਬੋਲੀ ਨੂੰ ਅਪਣਾ ਰਹੇ ਹਨ ਉਹ ਆਇਲੈਟਸ ਦੇ ਪਿੱਛੇ ਪਏ ਹਨ ਆਈਲੈਟਸ ਕਰਕੇ ਕਿ ਬਾਹਰ ਜਾਣਾ ਹੈ ਉਹ ਪੰਜਾਬੀ ਕਲਚਰ ਨੂੰ ਭੁੱਲਦੇ ਜਾ ਰਹੇ ਹਨ ਜੋ ਕਿ ਬਿਲਕੁਲ ਸਹੀ ਨਹੀਂ ਹੈ ਪੰਜਾਬੀ ਭਾਸ਼ਾ ਸਾਡੀ ਮਾਤ ਭਾਸ਼ਾ ਹੈ ਜੋ ਕਿ ਹਰ ਇੱਕ ਬੱਚੇ ਨੂੰ ਆਉਣੀ ਚਾਹੀਦੀ ਹੈ ਪਰ ਅੱਜ ਕੱਲ੍ਹ ਸਕੂਲਾਂ ਵਿੱਚ ਵੀ ਦੇਖ ਲਓ ਜਿੰਨੇ ਵੀ ਸਕੂਲ ਹਨ ਉਹ ਪਹਿਲੀ ਦੂਜੀ ਜਮਾਤ ਤੱਕ ਪੰਜਾਬੀ ਭਾਸ਼ਾ ਨਾ ਕਰਵਾ ਕੇ ਇੰਗਲਿਸ਼ ਅਤੇ ਹਿੰਦੀ ਭਾਸ਼ਾ ਵੱਲ ਜੋਰ ਦਿੰਦੇ ਹਨ ਜੋ ਕਿ ਬਿਲਕੁਲ ਸਹੀ ਨਹੀਂ ਹੈ ਪੰਜਾਬ ਵਿੱਚ ਰਹਿ ਕੇ ਪੰਜਾਬ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਹੀਂ ਆਉਂਦੀ ਹੁੰਦੀ ਜੇ ਇਸ ਨੂੰ ਵੇਖ ਕੇ ਸਾਨੂੰ ਬਹੁਤ ਹੀ ਦੁੱਖ ਹੋਣਾ ਚਾਹੀਦਾ ਹੈ ਸਰਕਾਰ ਨੂੰ ਯੋਜਨਾ ਅਪਣਾਉਣੀ ਚਾਹੀਦੀ ਹੈ ਕਿ ਪੰਜਾਬ ਵਿੱਚ ਜਿੰਨੇ ਵੀ ਹੀ ਸਕੂਲ ਹਨ ਸਾਰੇ ਪੰਜਾਬੀ ਭਾਸ਼ਾ ਵੱਲ ਜੋਰ ਦੇਣ ਤਾਂ ਕਿ ਸਾਡੇ ਨੌਜਵਾਨਾਂ ਨੂੰ ਪੰਜਾਬੀ ਭਾਸ਼ਾ ਦੀ ਮਹੱਤਤਾ ਦਾ ਪਤਾ ਚੱਲੇ ਇਹ ਬਹੁਤ ਹੀ ਜ਼ਰੂਰੀ ਹੈ ਉਸ ਤੋਂ ਬਾਅਦ ਹੋਰ ਵੀ ਕਈ ਤਰੀਕੇ ਹਨ ਜਿਸ ਨਾਲ ਅਸੀਂ ਪੰਜਾਬ ਭਾਸ਼ਾ ਨੂੰ ਪੰਜਾਬੀ ਭਾਸ਼ਾ ਦੀਆਂ ਚੁਣੌਤੀਆਂ ਨੂੰ ਦਰਸਾ ਸਕਦੇ ਹਾਂ ਆਪਣੇ ਨੌਜਵਾਨਾਂ ਨੂੰ ਬਾਹਰ ਨਾ ਜਾਣ ਅਤੇ ਉਹ ਇੱਥੇ ਹੀ ਵਧੀਆ ਰੁਜ਼ਗਾਰ ਦੇ ਦਿੱਤਾ ਜਾਵੇ ਤਾਂ ਕਿ ਉਹ ਬਾਹਰ ਜਾਣ ਦਾ ਜਿਹੜਾ ਸ਼ੌਂਕ ਉਹਨਾਂ ਦਾ ਖ਼ਤਮ ਹੋ ਜਾਵੇ ਸਰਕਾਰ ਨੂੰ ਇਹਨਾ ਚੀਜ਼ਾਂ ਵੱਲ ਕਦਮ ਉਠਾਉਣਾ ਚਾਹੀਦਾ ਹੈ ਤਾਂ ਕਿ ਉਹ ਇੱਥੇ ਹੀ ਪੰਜਾਬੀ ਵਿੱਚ ਬੋਲ ਕੇ ਪੰਜਾਬੀ ਦੀ ਭਾਸ਼ਾ ਨੂੰ ਚੰਗੀ ਤਰ੍ਹਾਂ ਅਪਣਾ ਕੇ ਚੰਗਾ ਰੁਜ਼ਗਾਰ ਕਰਨ ਚੰਗਾ ਕਮਾਉਣ ਚੰਗਾ ਰਹਿਣ ਸਹਿਣ ਵਿੱਚ ਆਪਣਾ ਦਿਲਚਸਪੀ ਵਧਾਉਣ ਜੋ ਕਿ ਬਹੁਤ ਜ਼ਰੂਰੀ ਹੈ ਪੰਜਾਬੀ ਭਾਸ਼ਾ ਜੇ ਸਾਡੀ ਮਾਤ ਬੋਲੀ ਹੈ ਜਿਸਨੂੰ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਧੰਨਵਾਦ